ਹਾਂ ਮੈਂ ਨਾ ਘਰ 'ਚ ਘਰੇਲੂ ਔਰਤ ਹਾਂ ਆਮ ਤੌਰ 'ਤੇ ਭਾਂਡੇ ਧੋਣ ਦੀ ਪ੍ਰਕਿਰਿਆ ਬਾਰੇ ਵੀ ਬਹੁਤ ਹੁੰਦੇ ਸੀ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਕਿ ਭਾਂਡੇ ਸਵਾਹ ਨਾਲ ਵੀ ਧੋਤੇ ਜਾਂਦੇ ਸੀ ਸਵਾਹ ਨਾਲ ਧੋਣ ਕਰਕੇ ਭਾਂਡੇ ਜਿਵੇਂ ਚੰਗੀ ਤਰ੍ਹਾਂ ਸਾਫ਼ ਹੋ ਜਾਂਦੇ ਨੇ ਕਿਉਂਕਿ ਸਾਡੀ ਮਦਰ ਜਦੋਂ ਮੈਂ ਛੋਟੇ ਹੁੰਦੇ ਸੀ ਸਾਡੇ ਮਾਤਾ ਨੂੰ ਦੇਖਦੀ ਸੀ ਮਾਤਾ ਨੂੰ ਦੇਖਦੀ ਹੁੰਦੀ ਸੀ ਭਾਂਡੇ ਧੋਂਦੀ ਨੂੰ ਜਿਵੇਂ ਕਿ ਉਹ ਧੋਤੇ ਜਾਂਦੇ ਹੁੰਦੇ ਸੀ ਵਧੀਆ ਸਵਾਹ ਨਾਲ ਭਾਂਡੇ ਧੋਤੇ ਜਾਂਦੇ ਪਿੰਡਾਂ ਵਿੱਚ ਤਾਂ ਕਾਫ਼ੀ ਤੌਰ 'ਤੇ ਹੁਣ ਵੀ ਧੋਂਦੇ ਰਹਿੰਦੇ ਨੇ ਸਵਾਹਾਂ ਨਾਲ ਭਾਂਡੇ ਧੋਣ ਦੇ ਨੇ ਅੱਜ ਕੱਲ੍ਹ ਵੀ ਧੋਤੇ ਜਾਂਦੇ ਨੇ ਕਿਉਂਕਿ ਸਵਾਹ ਨਾਲ ਭਾਂਡੇ ਚੰਗੀ ਤਰ੍ਹਾਂ ਨਿੱਖਰ ਜਾਂਦੇ ਸੀ ਅਤੇ ਹਾਈਜਨਕ ਹੋ ਜਾਂਦੇ ਸੀ ਅਤੇ ਸਾਫ਼ ਸੁਥਰੇ ਭਾਂਡੇ ਹੁੰਦੇ ਸੀ ਪਰ ਅੱਜ ਕਈ ਵਾਰ ਤਾਂ ਹੁਣ ਨਵੇਂ ਨਵੇਂ ਪ੍ਰੋਡੋਕਟ ਚੱਲੀ ਜਾਂਦੇ ਨੇ ਕੋਈ ਲਿਕੁਅਡ ਤੇ ਨਾ ਵੀ ਬਹੁਤ ਚੱਲੇ ਨੇ ਮੈਂ ਪੁਰਾਣੇ ਸਮੇਂ ਦੇ ਵਿੱਚ ਕੋਈ ਵੀ ਸਾਬਣ ਸੁਬਣ ਵੀ ਹੁੰਦੇ ਸੀ ਤਾਂ ਟੈਮ ਨਾ ਸੁਆ ਸਾਬਣ ਵੀ ਹੁੰਦੇ ਸੀ ਪਰ ਸਾਬਣ ਘੱਟ ਵੀ ਹੁੰਦੇ ਸੀ ਕਈ ਤਾਂ ਇਸ ਕਰਕੇ ਉਹਨਾਂ ਨਾਲ ਘੱਟ ਦੀ ਵੀ ਤੌਰ 'ਤੇ ਭਾਂਡੇ ਧੋਤੇ ਜਾਂਦੇ ਹੁੰਦੇ ਸੀ ਵਧੀਆ ਧੋਤੇ ਜਾਂਦੇ ਹੁੰਦੇ ਸੀ ਜਿਸ ਕਾਰਨ ਹੁਣ ਅੱਜ ਕੱਲ੍ਹ ਤਾਂ ਨਵੇਂ ਨਵੇਂ ਆਉਣ ਲੱਗ ਗਏ ਹਾਂ ਪਰ ਤੇਲ ਵਾਲੇ ਭਾਂਡੇ ਜਿਵੇਂ ਪਤਾ ਕਰਨੇ ਹੁੰਦੇ ਨੇ ਤਾਂ ਇਹਨਾਂ ਨੂੰ ਗਰਮ ਪਾਣੀ ਕਰ ਲਓ ਗਰਮ ਪਾਣੀ ਕਰਕੇ ਚੰਗੀ ਤਰ੍ਹਾਂ ਫਿਰ ਸਰ ਜਿਵੇਂ ਵੀ ਲੀਕੁਡ ਵਿੰਮ ਵੀ ਪਾ ਲਓ ਇਹਨਾਂ ਨਾਲ ਧੋਤੇ ਵੀ ਜਾਂਦੇ ਹਨ ਵਿੰਮ ਨਾਲ ਧੋਤੇ ਜਾਂਦੇ ਨੇ ਹੋਰ ਐਕਸੋ ਹੋ ਗਿਆ ਅਤੇ ਕਈ ਤਰ੍ਹਾਂ ਦੇ ਹੁਣ ਆਉਣ ਲੱਗ ਗਏ ਪ੍ਰੋਡਕਟ ਸਾਬਣ ਭਾਂਡੇ ਧੋਣ ਨੂੰ ਸਾਫ਼ ਕਰਨ ਵਾਲੇ ਅਤੇ ਹੁਣ ਤੁਸੀਂ ਕਈ ਤਰ੍ਹਾਂ ਦੇ ਬਰਤਨਾਂ ਨੂੰ ਧੋਣ ਇਹਨਾਂ ਤੇਲ ਦੇ ਬਰਤਨਾਂ ਨੂੰ ਧੋਣ ਲਈ ਸਾਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਪੈਂਦਾ ਅਤੇ ਗਰਮ ਪਾਣੀ ਨਾਲ ਪਾ ਕੇ ਭਾਂਡੇ ਛੇਤੀ ਸਾਫ਼ ਹੋ ਜਾਂਦੇ ਅਤੇ ਨਿੱਖਰ ਵੀ ਜਾਂਦੇ ਹਨ ਬਰਤਨ ਅਤੇ ਜਿਵੇਂ ਹੁਣ ਕਿੰਨੇ ਤਰ੍ਹਾਂ ਸਾਫ਼ ਹੋ ਜਾਂਦੇ ਹਨ ਅਤੇ ਅੱਜ ਕੱਲ੍ਹ ਤਾਂ ਲੀਕੁਅਡ ਵੀ ਆਉਂਦੇ ਨੇ ਜਿਵੇਂ ਸਾਬਣ ਲੀਕੁਅਡ ਵੀ ਆਉਣ ਲੱਗ ਜਾਂਦੇ ਨੇ ਇਸ ਕਰਕੇ ਭਾਂਡੇ ਨੂੰ ਸਾਫ਼ ਅਤੇ ਚੰਗੀ ਤਰ੍ਹਾਂ ਧੋਤੇ ਜਾਂਦੇ ਹਨ